ਹਾਂਜੀ ਨੌਜਵਾਨ ਪੀੜ੍ਹੀ ਨੂੰ ਤਾਂ ਆਪਾਂ ਤੁਹਾਨੂੰ ਕਹਿ ਹੀ ਨਹੀਂ ਸਕਦੇ ਠੀਕ ਹੈ ਰੀਤੀ ਰਿਵਾਜਾਂ ਦੀ ਪਾਲਣਾ ਕਰਨੀ ਮੀਨਜ਼ ਹੁਣ ਤਾਂ ਟਾਈਮ ਹੀ ਇੱਦਾਂ ਦਾ ਆ ਗਿਆ ਹੈ ਵੀ ਉਹ ਪਾਲਣਾ ਕਰਦੇ ਹੀ ਨਾ ਹੀ ਉਹਨਾਂ ਨੂੰ ਪਤਾ ਇੱਦਾਂ ਦਾ ਠੀਕ ਹੈ ਕਿੱਥੇ ਪਹਿਲਾਂ ਸੱਭਿਆਚਾਰਕ ਕਿੰਨੇ ਵਧੀਆ ਰੀਤੀ ਰਿਵਾਜ ਹੁੰਦੇ ਸੀ ਅਤੇ ਸਾਰੇ ਇਕੱਠੇ ਹੁੰਦੇ ਠੀਕ ਹੈ ਸਾਰੇ ਰੀਤੀ ਰਿਵਾਜ ਕਰਦੇ ਠੀਕ ਹੈ ਖੁਸ਼ ਹੁੰਦੇ ਗੱਲਾਂ ਬਾਤਾਂ ਹੁੰਦੀਆਂ ਮੀਨਜ਼ ਨੱਚਣਾ ਗਾਉਣਾ ਠੀਕ ਹੈ ਇਹ ਗੀਤ ਗਾਏ ਜਾਂਦੇ ਸੀ ਠੀਕ ਹੈ ਅਤੇ ਮੀਨਜ਼ ਇੱਦਾਂ ਦੇ ਗੀਤ ਗਾਏ ਜਾਂਦੇ ਸੀ ਜਿਹੜੇ ਸਾਰੇ ਸੁਣਦੇ ਸੀ ਠੀਕ ਹੈ ਰੀਤੀ ਰਿਵਾਜ ਇੱਦਾਂ ਦੇ ਹੁੰਦੇ ਸੀ ਜਿਹਨਾਂ ਬਾਰੇ ਸਾਰਿਆਂ ਨੂੰ ਪਤਾ ਲੱਗਦਾ ਸੀ ਆਪ ਦੀ ਸੱਭਿਆਚਾਰਕ ਬਾਰੇ ਪਤਾ ਲੱਗਦਾ ਸੀ ਵੀ ਹਾਂ ਸਾਡਾ ਸੱਭਿਆਚਾਰਕ ਕਿਹੋ ਜਿਹਾ ਹੈਗਾ ਠੀਕ ਹੈ ਇਹਦੇ ਵਿੱਚ ਕੀ ਕੁਛ ਹੈਗਾ ਠੀਕ ਹੈ ਪਰ ਹੁਣ ਹੁਣ ਤਾਂ ਉਦਾਂ ਦੀ ਹੈ ਨਹੀਂ ਨੌਜਵਾਨਾਂ ਨੂੰ ਇੱਦਾਂ ਦਾ ਕੁਛ ਹੈ ਹੀ ਨਹੀਂ ਨਾ ਉਹਨਾਂ ਨੂੰ ਸੱਭਿਆਚਾਰਕ ਬਾਰੇ ਪਤਾ ਠੀਕ ਹੈ ਨਾ ਉਹਨਾਂ ਨੂੰ ਕੋਈ ਆਉਣ ਵਾਲੇ ਕਲਚਰ ਬਾਰੇ ਪਤਾ ਹੈ ਵੀ ਕੀ ਹੈਗਾ ਕਿੱਦਾਂ ਦੇ ਰੀਤੀ ਰਿਵਾਜ ਆ ਉਹਨਾਂ ਦੀ ਪਾਲਣਾ ਕਰਨੀ ਹੈ ਜਾਂ ਨਹੀਂ ਕਰਨੀ ਠੀਕ ਹੈ ਨਾ ਹੀ ਉਹ ਉਦਾਂ ਦੀ ਪਾਲਣਾ ਕਰਦੇ ਆ ਠੀਕ ਹੈ ਉਹ ਇਹਨਾਂ ਚੀਜ਼ਾਂ ਨੂੰ ਮੀਨਜ਼ ਉਹਨੂੰ ਇਹ ਲੈਂਦੇ ਹੀ ਨਹੀਂ ਇਸ ਕਰਕੇ ਸਾਡਾ ਉਹ ਪੱਛੜਦਾ ਜਾ ਰਿਹਾ ਠੀਕ ਹੈ ਅਸੀਂ ਇਹਨੂੰ ਕੋਈ ਬੱਚਾ ਸੱਭਿਆਚਾਰਕ ਨੂੰ ਸੀਰੀਅਸ ਨਹੀਂ ਲੈਂਦਾ ਰੀਤੀ ਰਿਵਾਜਾਂ ਨੂੰ ਮੰਨਦਾ ਨਹੀਂ ਮੰਨਦਾ ਹੋਵੇ ਤਾਂ ਸੱਭਿਆਚਾਰਕ ਕਾਇਮ ਰਹੇ